ਗੂਗਲ ਮੈਪਸ ਦੀ ਵਰਤੋਂ ਅੱਜ ਕੱਲ੍ਹ ਹਰ ਕੋਈ ਕਰਦਾ ਹੈ ਗੂਗਲ ਮੈਪਸ ਦੀ ਵਰਤੋਂ ਨਾਲ ਅਸੀਂ ਘਰ ਬੈਠੇ ਕਿਸੇ ਵੀ ਲੋਕੇਸ਼ਨ ਦੀ ਨੂੰ ਦੇਖ ਸਕਦੇ ਹਾਂ ਜਾਂ ਕਿਸੇ ਵੀ ਲੋਕੇਸ਼ਨ ਤੱਕ ਅਗਰ ਪੁੱਜਣਾ ਹੋਵੇ ਤਾਂ ਆਪਾਂ ਗੂਗਲ ਮੈਪ ਦੀ ਵਜ੍ਹਾ ਨਾਲ ਪੁੱਜ ਸਕਦੇ ਹਾਂ ਉਹ ਕਿਸੇ ਅਗਰ ਬਾਇਕ ਵਿੱਚ ਜਾਣਾ ਹੋਵੇ ਤਾਂ ਉਹ ਬਾਈਕ ਦੀ ਤਰ੍ਹਾਂ ਗੂਗਲ ਮੇਂ ਸਾਨੂੰ ਸੰਦੇਸ਼ ਭੇਜਦਾ ਹੈ ਅਤੇ ਅਗਰ ਗੱਡੀ ਵਿੱਚ ਜਾਣਾ ਹੋਵੇ ਜਾਂ ਕਿਸੇ ਵੀ ਸਾਧਨ ਉੱਤੇ ਜਾਣਾ ਹੋਵੇ ਤਾਂ ਗੂਗਲ ਮੈਪ ਸਾਨੂੰ ਸਹੀ ਰਸਤਾ ਦਿਖਾਉਂਦਾ ਅਤੇ ਉਸ ਦੀ ਵਜ੍ਹਾ ਨਾਲ ਅਸੀਂ ਕਿਸੇ ਵੀ ਸਥਾਨ ਉੱਤੇ ਜਿੱਥੇ ਜਾਣਾ ਚਾਹੁੰਦੇ ਹਾਂ ਉੱਥੇ ਸਹੀ ਤਰੀਕੇ ਨਾਲ ਪਹੁੰਚ ਜਾਂਦੇ ਹਾਂ ਇਹ ਬਹੁਤ ਹੀ ਵਧੀਆ ਮੈਪ ਹੈ ਇਹ ਸਾਨੂੰ ਕਰੰਟ ਲੋਕੇਸ਼ਨ 'ਤੇ ਪਹੁੰਚਾ ਦਿੰਦਾ ਹੈ ਅਤੇ ਗੂਗਲ ਮੈਪ ਦੀ ਵਜ੍ਹਾ ਨਾਲ ਅੱਜ ਹਰ ਕੋਈ ਬਹੁਤ ਹੀ ਇਹ ਬਹੁਤ ਹੀ ਸਹੂਲਤ ਪ੍ਰਦਾਨ ਕਰਦਾ ਹੈ ਇਸ ਨਾਲ ਹਰ ਕੋਈ ਕਿਤੇ ਵੀ ਜਾ ਸਕਦਾ ਹੈ ਅਤੇ ਬਿਨ੍ਹਾਂ ਕੋਈ ਅਗਰ ਉਹਨਾਂ ਨੂੰ ਰਸਤਾ ਨਾ ਵੀ ਪਤਾ ਹੋਵੇ ਤਾਂ ਉਹ ਮੈਪ ਦੀ ਵਰਤੋਂ ਨਾਲ ਸਹੀ ਕਰੰਟ ਲੋਕੇਸ਼ਨ 'ਤੇ ਪਹੁੰਚ ਸਕਦਾ ਹੈ ਇਸ ਲਈ ਗੂਗਲ ਮੈਪ ਅੱਜ ਬਹੁਤ ਹੀ ਵਧੀਆ ਐਪ ਹੈ